ਹੈਲੋ ਸਰ ਮੀਸ਼ੋ ਤੋਂ ਬੋਲਦੇ ਜੇ ਸਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜਿਹੜੇ ਪ੍ਰੋਡਕਟ ਮੰਗਵਾਏ ਸੀ ਪ੍ਰੋਡਕਟ ਪਹਿਲਾਂ ਮੈਂ ਦੋ ਪ੍ਰੋਡਕਟ ਮੰਗਵਾਏ ਸੀ ਪਹਿਲਾਂ ਮੈਂ ਪ੍ਰੋਡਕਟ ਮੰਗਵਾਇਆ ਸੀ ਫੇਸ ਲਈ ਕਰੀਮ ਮੰਗਵਾਈ ਸੀ ਉਹ ਬਹੁਤ ਵਧੀਆ ਨਿਕਲੀ ਜਿਹੜਾ ਮੈਂ ਸੈਕਿੰਡ ਮੰਗਵਾਇਆ ਸੀ ਆਪਣੇ ਲਈ ਲਪਿਸਟਿਕਾਂ ਮੰਗਵਾਈਆਂ ਸੀ ਉਹ ਲਪਿਸਟਿਕਾਂ ਬਹੁਤ ਹੀ ਖਰਾਬ ਨਿਕਲੀਆਂ ਸੀ ਉਨ ਮੈਂ ਜਦੋਂ ਵੀ ਆਪਣੇ ਲਿਪਸ 'ਤੇ ਲਪਿਸਟਿਕ ਨੂੰ ਲਗਾਉਂਦੀ ਸੀ ਉਹ ਲਪਿਸਟਿਕ ਬਹੁਤ ਹੀ ਸ਼ੇਡ ਛੱਡਦੀ ਸੀ ਹੀ ਨਾਲ ਹੀ ਉਹ ਜਲਦੀ ਹੀ ਉਤਰ ਜਾਂਦੀ ਸੀ ਸਰ ਉਹਦੇ ਨਾਲ ਮੇਰੇ ਲਿਪਸ ਵੀ ਖਰਾਬ ਹੋ ਗਏ ਆ ਨਾਲੇ ਮੇਰੇ ਜਦੋਂ ਵੀ ਉਹ ਕਾਲਾ ਕਾਲਾ ਪਨ ਜਿਹਾ ਆ ਜਾਂਦਾ ਸੀ ਸਰ ਮੈਂ ਇੰਨਾ ਜ਼ਿਆਦਾ ਵਧੀਆ ਪ੍ਰੋਡਕਟ ਮੰਗਵਾਇਆ ਸੀ ਵੀ ਬਹੁਤ ਹੀ ਵਧੀਆ ਨਿਕਲੂਗਾ ਪਰ ਉਹ ਤਾਂ ਜ਼ਿਆਦਾ ਹੀ ਖਰਾਬ ਨਿਕਲਿਆ ਮੈਂ ਇਹਦੇ ਬਾਰੇ ਹੀ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਪਹਿਲਾ ਪ੍ਰੋਡਕਟ ਮੇਰਾ ਬਹੁਤ ਹੀ ਵਧੀਆ ਨਿਕਲਿਆ ਇਸ ਲਈ ਹੀ ਮੈਂ ਆਪਣਾ ਦੂਸਰਾ ਪ੍ਰੋਡਕਟ ਮੰਗਵਾਇਆ ਸੀ ਇਸ ਕਰਕੇ ਸਰ ਮੈਂ ਇਹਦੇ ਬਾਰੇ ਹੀ ਤੁਹਾਡੇ ਨਾਲ ਕੋਈ ਸ਼ਿਕਾਇਤ ਕਰਨੀ ਸੀ ਵੀ ਹਰੇਕ ਕੋਈ ਤੁਹਾਡੇ ਤੁਹਾਡੇ ਮੀ ਐਪ ਮੀਸ਼ੋ ਐਪ ਤੋਂ ਬੜੇ ਚਾਅ ਨਾਲ ਇਹ ਚੀਜ਼ ਮੰਗਵਾਉਂਦਾ ਹੈ ਬਟ ਉਹਨੂੰ ਤੁਸੀਂ ਪੂਰੀ ਕੇਅਰਫੁਲ ਦੇ ਨਾਲ ਦੇਖ ਕੇ ਫਿਰ ਭੇਜਿਆ ਕਰੋ ਕਿਸੇ ਦੇ ਘਰ